ਹੈਲੋ ਸਤਿ ਸ਼੍ਰੀ ਅਕਾਲ ਬਾਈ ਜੀ ਹਾਂਜੀ ਹਾਂਜੀ ਬਾਈ ਜੀ ਹਾਂਜੀ ਅੱਛਾ ਜੀ ਠੀਕ ਹੈ ਜੀ ਹਾਂਜੀ ਹਾਂ ਵੀਰ ਜੀ ਜਰੂਰ ਜਾਣਕਾਰੀ ਤੁਹਾਨੂੰ ਦੇਵਾਂਗੇ ਅਸੀਂ ਫੋਨਾਂ ਬਾਰੇ ਬਾਈ ਫੋਨ ਨਾ ਆਪਣੇ ਬਹੁਤ ਤਰ੍ਹਾਂ ਆਉਂਦੇ ਆ ਅਤੇ ਉਹਦੇ 'ਚ ਤੁਸੀਂ ਮੈਨੂੰ ਰੇਟ ਵਗੈਰਾ ਦੱਸੋ ਕਿ ਕਿੰਨੇ ਕੁ ਪ੍ਰਾਈਜ਼ 'ਚ ਤੁਸੀਂ ਲਾਉਣੇ ਆ ਉਹਦੇ ਹਿਸਾਬ ਨਾਲ ਮੈਂ ਤੁਹਾਨੂੰ ਦੱਸਦਾ ਜੀ ਬਈ ਸੈਮਸੰਗ ਦੀ ਨਾ ਤਿੰਨ ਚਾਰ ਸੀਰੀਜ਼ ਚੱਲਦੀ ਆ ਇੱਕ ਤਾਂ ਏ ਸੀਰੀਜ਼ ਚੱਲ ਰਹੀ ਹੈ ਜੀ ਇੱਕ ਐੱਫ ਸੀਰੀਜ਼ ਚੱਲ ਰਹੀ ਆ ਇੱਕ ਐੱਸ ਸੀਰੀਜ਼ ਚੱਲ ਰਹੀ ਆ ਇਹ ਜਿਹੜੀ ਐੱਸ ਸੀਰੀਜ਼ ਆ ਉਹ ਤਾਂ ਬਹੁਤ ਮਹਿੰਗੀ ਹੈ ਫੋਨ ਆਉਂਦੇ ਪੂਰੇ ਮਤਲਬ ਡੇਢ ਲੱਖ ਦੇ ਫੋਨ ਆ ਜਾਂ ਸੱਤਰ ਦੇ ਮਹਿੰਗੇ ਫੋਨ ਨੇ ਜਿਹੜੇ ਏ ਸੀਰੀਜ ਹੈ ਇਹ ਦਰਮਿਆਨੀ ਆ ਮਤਲਬ ਪੱਚੀ ਹਜ਼ਾਰ ਤੋਂ ਲੈ ਕੇ ਪੈਂਤੀ ਹਜ਼ਾਰ ਅਤੇ ਨਾਲੇ ਠੀਕ ਹੈ ਜੀ ਵਧੀਆ ਵਾਜਿਬ ਨੇ ਹਾਂ ਅਤੇ ਜੇ ਕੋਈ ਐਪਲ ਵਾਲਾ ਦੇ ਹਾਂਜੀ ਹਾਂ ਐਪਲ ਦੇ ਵੀ ਮਾਡਲ ਆਉਂਦੇ ਐਪਲ ਦੇ ਭਾਅ ਜੀ ਥੋੜ੍ਹੇ ਜਿਹੇ ਰੇਟ ਵੱਧ ਨੇ ਐਪਲ ਦਾ ਘੱਟ ਤੋਂ ਘੱਟ ਸਟਾਰਟ ਥੋਨੂੰ ਪੰਜਾਹ ਤੋਂ ਉੱਤੇ ਉਹ ਉੱਤੇ ਉੱਤੇ ਮਿਲੂਗਾ ਜੇ ਨਵਾਂ ਫੋਨ ਲੈਣਾ ਜੀ ਆਪਾਂ ਐਪਲ ਦੇ ਭਾਅ ਜੀ ਆਪਣਾ ਪੈਂਹਠ ਕੁ ਦਾ ਜੀ ਪੈਂਦਾ ਜੀ ਆਪਣਾ ਹਾਂਜੀ ਹਾਂ ਉਸ ਤੋਂ ਬਾਅਦ ਤਾਂ ਬਾਈ ਜੀ ਆਪਣਾ ਆਪਣਾ ਡੇਢ ਲੱਖ ਤੱਕ ਚਲਿਆ ਜਾਂਦਾ ਜਿਹੜਾ ਕਿਉਂਕਿ ਪੰਦਰ੍ਹਾਂ ਪਰੋ ਆਇਆ ਨਾ ਉਹ ਇੱਕ ਪੈਂਹਠ ਦੇ ਲਵੇ ਆ ਬਾਈ ਕੈਮਰੇ ਪੱਖੋ ਤਾਂ ਯਾਰ ਬਹੁ ਫੋਨ ਬਾਈ ਜੀ ਸਭ ਤੋਂ ਵਧੀਆ ਫੋਨ ਤਾਂ ਐਪਲ ਦੇ ਬਣਦੇ ਆ ਜੀ ਐਪਲ ਦਾ ਜਿਹੜਾ ਇੱਕ ਤਾ ਕੈਮਰਾ ਬਹੁਤ ਵਧੀਆ ਇੱਕ ਆਈ ਓ ਐੱਸ ਬਹੁਤ ਵਧੀਆ ਇੱਕ ਇਹਦੇ ਜਿਹੜਾ ਆਪਾਂ ਜੋ ਟਾਈਪਿੰਗ ਟੁਈਪਿੰਗ ਕਰਦੇ ਹਾਂ ਉਹ ਬਹੁਤ ਵਧੀਆ ਹਾਂ ਬਾਈ ਤੁਸੀਂ ਨਾ ਹੁਣ ਤਾਂ ਨਾ ਇੱਕ ਦੋ ਦਿਨਾਂ ਦਾ ਬ ਵੈਸੇ ਤਾਂ ਦੁਕਾਨ ਖੁੱਲੀ ਹੁੰਦੀ ਆ ਅਸੀਂ ਨਾ ਇੱਕ ਦੋ ਦਿਨਾਂ ਤੱਕ ਵਿਆਹ 'ਤੇ ਜਾਣਾ ਅਤੇ ਤੁਸੀਂ ਐਤਵਾਰ ਜਾਂ ਛੁੱਟੀ ਵਾਲੇ ਦਿਨ ਕਿਸੇ ਦਿਨ ਟਾਈਮ ਕੱਢ ਕੇ ਤੁਹਾਡੇ ਕੋਲ ਮੇਰਾ ਨੰਬਰ ਤਾਂ ਹੈਗਾ ਅਤੇ ਫੋਨ ਕਰਕੇ ਆਇਓ ਜਰੂਰ ਮੈਨੂੰ ਫਿਰ ਮੈਂ ਮੈਨੂੰ ਹਾਂ ਅਤੇ ਤੁਸੀਂ ਦੇਖ ਲਿਓ ਮਾਡਲ ਮੁਡਲ ਨਾ ਜਿਹੜੇ ਤੁਹਾਨੂੰ ਮਤਲਬ ਠੀਕ ਲੱਗੇ ਤੁਸੀਂ ਮੈਨੂੰ ਦੱਸ ਦਿਓ ਪ੍ਰਾਈਜ ਅਸਲ ਤਾਂ ਪ੍ਰਾਈਜ ਦੇਖ ਲਿਓ ਜੀ ਤੁਸੀਂ ਨਾ ਕਿਉਂਕਿ ਜਿਹੜਾ ਆਪਣਾ ਪ੍ਰਾਈਜ ਉਹਦੇ ਹਿਸਾਬ ਨਾਲ ਰੈਮ ਅਤੇ ਸਾਰਾ ਕੁਆਲਿਟੀ ਉਹ ਸਾਰਾ ਕੁਛ ਹੁੰਦਾ ਹਾਂਜੀ ਹਾਂ ਠੀਕ ਚਲੋ ਬਾਈ ਠੀਕ ਹੈ ਜੀ ਬਾਈ ਓਕੇ